ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਤੁਹਾਡੇ ਕੋਲੋਂ ਭਾਅ ਜੀ ਜਿਹੜਾ ਦੋ ਹਫ਼ਤੇ ਪਹਿਲਾਂ ਫੋਨ ਮੰਗਵਾਇਆ ਸੀ ਮੈਨੂੰ ਉਹ ਬਹੁਤ ਵਧੀਆ ਲੱਗਿਆ ਉਹਦੀ ਤੁਸੀਂ ਉਹਨੂੰ ਮੈਨੂੰ ਕਿਹਾ ਸੀ ਕਿ ਉਹ ਫੋਨ ਇੱਕ ਹਫ਼ਤੇ ਵਿੱਚ ਡਿਲੀਵਰ ਹੋਵੇਗਾ ਪਰ ਉਹ ਤੁਹਾਡੀ ਪੈਕਿੰਗ ਦੋ ਦਿਨ ਪਹਿਲਾਂ ਹੀ ਡਿਲੀਵਰ ਹੋ ਗਈ ਜਿਸ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਜਿਹਨੇ ਤੁਹਾਨੂੰ ਪੈਕਿੰਗ ਵਾਲਾ ਬੰਦਾ ਤਾ ਉਹਨੇ ਬਹੁਤ ਵਧੀਆ ਢੰਗ ਨਾਲ ਡਿਲੀਵਰੀ ਕੀਤੀ ਅਤੇ ਮੈਨੂੰ ਬੜੇ ਮਾਣ ਸਤਿਕਾਰ ਨਾਲ ਉਹਨੇ ਦੇ ਕੇ ਗਿਆ ਗਿਫਟ ਅਤੇ ਨਾਲ ਉਹਨੇ ਮੈਨੂੰ ਗਿਫਟ ਵੀ ਦਿੱਤਾ ਤੁਹਾਡਾ ਮੈਂ ਲੱਕੀ ਕਸਟਮਰ ਰਿਹਾ ਤੁਸੀਂ ਉਹਨੂੰ ਗਿਫਟ ਭੇਜਿਆ ਸੀ ਉਹ ਗਿਫਟ ਕਾਰਨ ਮੈਨੂੰ ਬਹੁਤ ਅੰਦਰੋਂ ਖੁਸ਼ੀਂ ਹੋਈ ਅਤੇ ਜਿਹੜਾ ਤੁਹਾਡਾ ਫੋਨ ਹੈ ਆਈਫੋਨ ਫੀਫਟੀਨ ਪਰੋ ਮੈਕਸ ਥਾ ਮੈਨੂੰ ਉਹਦਾ ਪ੍ਰਸੈਸਰ ਕੈਮਰਾ ਸਪੀਕਰ ਸਾਰੇ ਬਹੁਤ ਵਧੀਆ ਲੱਗੇ ਜਿਹਦੇ ਕਰਕੇ ਮੈਂ ਤੁਹਾਨੂੰ ਖੁਸ਼ੀ ਆਪਣੇ ਖੁਸ਼ੀ ਤੋਂ ਤੁਹਾਨੂੰ ਮੈਸਿਜ ਹੀ ਭੇਜ ਰਿਹਾ ਹਾਂ ਕਿਸ ਕਾਰਨ ਤੁਸੀਂ ਕੋਈ ਵੀ ਇੱਦਾਂ ਦਾ ਕੋਈ ਵਧੀਆ ਫੋਨ ਆਵੇ ਤਾਂ ਮੈਨੂੰ ਜ਼ਰੂਰ ਰੀਕਮੈਂਡ ਕਰਿਓ ਕਿਉਂਕਿ ਮੈਂ ਆਪਣੀ ਫੈਮਿਲੀ ਆਪਣੇ ਭਾਈ ਆਪਣੇ ਭੈਣ ਕਿਸੇ ਨ ਵਾਸਤੇ ਦੇਖ ਰਿਹਾ ਹਾਂ ਇਸ ਕਾਰਨ ਤੁਸੀਂ ਕਦੇ ਵੀ ਕੋਈ ਵੀ ਵਧੀਆ ਫੋਨ ਹੋਵੇ ਤਾਂ ਮੈਨੂੰ ਭੇਜੀ ਮੈਨੂੰ ਪਲੀਜ਼ ਇੱਕ ਵਾਰ ਕੰਟੈਕਟ ਕੀਤਾ ਜਾਵੇ ਅਤੇ ਨਾਲ ਕਿਰਪਾ ਕਰਕੇ ਮੈਨੂੰ ਕੋਈ ਅੱਗੇ ਤੋਂ ਹਮੇਸ਼ਾ ਵਧੀਆ ਰਿਵਿਊ ਕੋਈ ਵੀ ਹੋਵੇ ਜਾਂ ਕੋਈ ਫੋਨ ਹੋਵੇ ਤਾਂ ਮੈਨੂੰ ਪਲੀਜ਼ ਧੰਨਵਾਦ ਭੇਜਿਆ ਜਾਵੇ